ਹੈਲੋ ਵੀਰੇ ਸਤਿ ਸ਼੍ਰੀ ਅਕਾਲ ਅਸੀਂ ਸਿੱਧੂ ਤੁਸੀਂ ਸਿੱਧੂ ਰੈਸਟੋਰੈਂਟ ਤੋਂ ਬੋਲ ਰਹੇ ਹੋ ਅਸੀਂ ਸਾਡੀ ਪਾਰਟੀ ਸੀਗੀ ਜਿਹਦੇ ਕਰਕੇ ਤੁਹਾਡੇ ਰੈਸਟੋਰੈਂਟ ਤੋਂ ਅਸੀਂ ਪੀਜ਼ਾ ਅਤੇ ਬਰਗਰ ਆਡਰ ਕੀਤਾ ਸੀਗਾ ਜਿਹਦੇ ਵਿੱਚ ਪੀਜ਼ਾ ਬਹੁਤ ਹੀ ਵਧੀਆ ਸੀਗਾ ਅਤੇ ਜਿਹੜਾ ਬਰਗਰ ਸੀਗਾ ਉਹ ਇੰਨਾ ਸਵਾਦ ਨਹੀਂ ਸੀਗਾ ਪੀਜ਼ੇ ਵਿੱਚ ਬਹੁਤ ਹੀ ਵਧੀਆ ਚੀਜ਼ ਫਲੈਕਸ ਅਤੇ ਸਾਰਾ ਕੋਰਨਸ ਵਗੈਰਾ ਸਾਰਾ ਸੀਗਾ ਅਤੇ ਜਿਹਦੇ ਵਿੱਚ ਬਰਗਰ ਹੈ ਬਰਗਰ ਦੇ ਵਿੱਚ ਵੈਜੀਟੇਬਲ ਘੱਟ ਸੀਗੇ ਚਿਲੀ ਸੋਸ ਜ਼ਿਆਦਾ ਸੀਗੀ ਜਿਹਦੇ ਕਰਕੇ ਬਰਗਰ ਇੰਨਾ ਸਵਾਦ ਨਹੀਂ ਲੱਗਿਆ ਪੀਜ਼ਾ ਬਹੁਤ ਸਵਾਦ ਸੀਗਾ ਜਿਹਦੇ ਕਰਕੇ ਪੀਜ਼ਾ ਜਿਹੜਾ ਸਾਡੇ ਮਤਲਬ ਗੈਸਟ ਵਗੈਰਾ ਨੂੰ ਅਤੇ ਬੱਚਿਆਂ ਵਗੈਰਾ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਅਤੇ ਜਿਹੜਾ ਬਰਗਰ ਆ ਉਹ ਕਿਸੇ ਨੂੰ ਪਸੰਦ ਨਹੀਂ ਆਇਆ ਅੱਗੇ ਤੋਂ ਜਦੋਂ ਵੀ ਅਸੀਂ ਪੀਜ਼ਾ ਜਾਂ ਬਰਗਰ ਆਡਰ ਕਰੀਏ ਪੀਜ਼ਾ ਤਾਂ ਸਹੀ ਸੀਗਾ ਲੇਕਿਨ ਜਿਹੜਾ ਬਰਗਰ ਸੀਗਾ ਉਹਦੇ ਵਿੱਚ ਤੁਸੀਂ ਚਿੱਲੀ ਸਾਸ ਘੱਟ ਪਾਉਣੀ ਹੈਗੀ ਅਤੇ ਵੈਜੀਟੇਬਲ ਜਿਹੜੇ ਉਹ ਵੱਧ ਰੱਖਣੇ ਹੈਗੇ ਤਾਂ ਕਿ ਬਰਗਰ ਵੀ ਤੁਹਾਡਾ ਬਹੁਤ ਵਧੀਆ ਲੱਗੇ ਤਾਂ ਵੈਸੇ ਵੀ ਜਦੋਂ ਵੀ ਅਸੀਂ ਸਾਡੇ ਘਰ 'ਚ ਕੋਈ ਪਾਰਟੀ ਹੁੰਦੀ ਆ ਜਾਂ ਕੋਈ ਗੈਸਟ ਆਉਂਦਾ ਜਾਂ ਵੈਸੇ ਕੋਈ ਬੱਚਿਆਂ ਦਾ ਮੋਡ ਹੁੰਦਾ ਖਾਣ ਨੂੰ ਤਾਂ ਅਸੀਂ ਤੁਹਾਡੇ ਰੈਸਟੋਰੈਂਟ ਤੋਂ ਹੀ ਆਰਡਰ ਕਰਦੇ ਹਾਂ ਤਾਂ ਕਿ ਇੱਥੋਂ ਦੀਆਂ ਚੀਜ਼ਾਂ ਸਾਨੂੰ ਬਹੁਤ ਵਧੀਆ ਲੱਗਦੀਆਂ ਹਨ ਨਾਲ ਟਾਈਮ ਸਿਰ ਆ ਜਾਂਦੀਆਂ ਸਨ ਅੱਗੇ ਤੋਂ ਜਦੋਂ ਵੀ ਅਸੀਂ ਭੇਜੀਏ ਆਰਡਰ ਕਰੀਏ ਤੁਸੀਂ ਐਂਈ ਸਾਨੂੰ ਪੈ ਟਾਈਮ ਸਿਰ ਭੇਜਣਾ ਹੈ ਟਾਈਮ ਸਿਰ ਭੇਜ ਕੇ ਭੇਜਣਾ ਹੈ ਤਾਂ ਕਿ ਸਾਡੇ ਕੋਲ ਟਾਈਮ ਸਿਰ ਪਹੁੰਚ ਜਾਣ ਇਸ ਲਈ ਤੁਹਾਡੇ ਭੇਜੀਆਂ ਹੋਈਆਂ ਚੀਜ਼ਾਂ ਸਨ ਇਹ ਮੇਰੇ ਮੰਮੀ ਪਾਪਾ ਸਾਡੇ ਫੈਮਲੀ ਮੈਂਬਰ ਅਤੇ ਸਾਡੇ ਬੱਚੇ ਬਹੁਤ ਹੀ ਸ਼ੌਕ ਨਾਲ ਖਾਂਦੇ ਹਨ ਜਿਹਦੇ ਵਿੱਚ ਸਾਡਾ ਤੁਹਾਡਾ ਸਮਾਨ ਆ ਬਹੁਤ ਵਧੀਆ ਲੱਗਦਾ ਹੈ ਅਤੇ ਜੇ ਤੁਸੀਂ ਅੱਗੇ ਤੋਂ ਵਧੀਆ ਭੇਜਣਾ ਹੈ ਜਾਂ ਕਿ ਸਾਡੇ ਕੋਲ ਟਾਈਮ ਸਿਰ ਪਹੁੰਚ ਜਾਵੇ ਅਤੇ ਧੰਨਵਾਦ ਥੈਂਕ ਯੂ ਸੋ ਮੱਚ